ਸਾਡੇ ਇਲਾਕੇ ਵਿੱਚ ਗਰਮੀ ਦੀ ਰੁੱਤ ਤਕਰੀਬਨ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਹੁਣ ਮੌਸਮੀ ਬਦਲਾਵ ਹੋਣ ਕਰਕੇ ਗਰਮੀ ਕੁਝ ਥੋੜਾ ਸਮਾਂ ਪਹਿਲਾਂ ਹੀ ਆ ਗਈ ਹੁਣ ਫਰਵਰੀ ਤੋਂ ਹੀ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਚੁੱਕੀ ਹੈ ਇਹ ਗਰਮੀ ਇੰਨੀ ਜ਼ਿਆਦਾ ਹੈ ਕਿ ਅਗ ਕਿ ਅਪ੍ਰੈਲ ਮਈ ਦੇ ਮਹੀਨੇ ਵਿੱਚ ਹੀ ਇੱਦਾਂ ਲੱਗਦਾ ਹੈ ਕਿ ਜੂਨ ਜੁਲਾਈ ਆ ਗਈ ਹੈ ਬਾਅਦ ਵਿੱਚ ਸਾਡੇ ਜੂਨ ਜੁਲਾਈ ਦੇ ਤਕਰੀਬਨ ਵਿੱਚ ਨੂੰ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ ਪੰਜਾਬ ਵਿੱਚ ਮੋਨਸੂਨ ਆ ਜਾਂਦਾ ਹੈ ਇਹ ਬਰਸਾਤ ਵਿੱਚ ਮੀਂਹ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਜੋ ਕਿ ਝੋਨੇ ਦੀ ਫਸਲ ਲਈ ਬਹੁਤ ਜ਼ਿਆਦਾ ਵਧੀਆ ਹੈ ਪਰ ਹੁਣ ਮੌਸਮੀ ਬਦਲਾਓ ਕਰਕੇ ਇਹ ਬਰਸਾਤਾਂ ਵੀ ਅੱਗੇ ਪਿੱਛੇ ਹੋਣ ਲੱਗ ਗਈਆ ਹਨ ਅਤੇ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਸਰਦੀ ਦੀ ਰੁੱਤ ਉਰੇ ਤਕਰੀਬਨ ਅਕਤੂਬਰ ਤੋਂ ਆਉਂਦੀ ਹੈ ਅਤੇ ਅਤੇ ਜਨਵਰੀ ਤੱਕ ਰਹਿੰਦੀ ਹੈ ਪਰ ਹੁਣ ਗਰਮੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਸਰਦੀ ਕੁਛ ਥੋੜੇ ਜੇ ਸਮੇਂ ਦੀ ਹੀ ਰਹਿ ਗਈ ਹੈ ਹੁਣ ਬਸ ਦਸਬੰਰ ਨਵ ਨਵੰਬਰ ਦਸੰਬਰ ਅਤੇ ਜਨਵਰੀ ਵਿੱਚ ਹੀ ਠੰਡ ਸੀਮਿਤ ਰਹਿ ਗਈ ਹੈ ਅਤੇ ਬਸੰਤ ਰੁੱਤ ਉਰੇ ਦੀ ਬਹੁਤ ਮਨ ਭਾਉਂਦੀ ਹੁੰਦੀ ਹੈ ਅਤੇ ਇਹ ਇੱਦਾਂ ਲੱਗਦਾ ਹੈ ਕਿ ਸਾਡਾ ਇਲਾਕਾ ਸਵਰਗ ਬਣ ਗਿਆ ਹੈ ਅਤੇ ਉਰੇ ਦਾ ਮੌਸਮ ਵੀ ਬਹੁਤ ਵਧੀਆ ਹੋ ਜਾਂਦਾ ਹੈ